ਸਵੱਸਥਾ ਹੀ ਲੰਬੀ ਉਮਰ ਦਾ ਰਾਜ ਹੈ ਅੱਜ ਕੱਲ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਬੰਦੇ ਤਾਂ ਕਿ ਨੂੰ ਬਿਮਾਰੀਆਂ ਲੱਗ ਰਹੀ ਆ ਹਨ ਤਾਂ ਉਹ ਕੀ ਉਹ ਬਾਹਰ ਦਾ ਭੋਜਨ ਬਹੁਤ ਹੀ ਖਾਂਦੇ ਹਨ ਪਰ ਐਨ ਐਸ ਤੀਜ਼ ਦਾ ਛੁਟਕਾਰਾ ਪਾਉਣ ਵਾਸਤੇ ਸਾਨੂੰ ਘਰਦੀਆਂ ਬਨੀਆ ਸਬਜੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਐਕਸਰਸਾਈਜ ਰਨਿੰਗ ਵੋਕਿੰਗ ਤੇ ਸਾਈਕਲ ਵੀ ਕਰਨੀ ਚਾਹੀਦੀ ਐ ਦੋੜ ਦੀ ਤਿਆਰੀ ਵਿੱਚ ਪੋਸ਼ਨ ਅਤੇ ਹਾਈਡਰੇਸ਼ਨ ਵੀ ਸਾਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਜਿਵੇਂ ਕੀ ਸਾਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਹਾਈਡਰੇਸ਼ਨ ਇਸ ਕਾਰਨ ਕਿ ਸਾਨੂੰ ਜਦੋਂ ਪਾਣੀ ਪੀਣਾ ਚਾਹੀਦਾ ਤਾਂ ਕੀ ਪਾਣੀ ਦੀ ਕਮੀ ਸਾਡੇ ਸਰੀਰ ਵਿੱਚ ਨਾ ਰਵੇ ਅਤੇ ਹਮੇਸ਼ਾ ਦੌੜ ਕਰਨ ਨਾਲ ਸਾਡੀ ਹੱਡੀਆਂ ਮਜਬੂਤ ਰਹਿੰਦੀਆਂ ਹਨ ਬਿਲਕੁਲ ਦਾਲਾ ਸਬਜੀਆ ਹਰੀ ਸਬਜ਼ੀਆਂ ਖਾਨੀਆਂ ਵੀ ਬਹੁਤ ਜਰੂਰੀ ਹਨ ਤਾਂ ਕਿ ਸਾਡੇ ਵਿੱਚ ਫੁਰਤੀਲੀ ਅਤੇ ਚੁਸਤੀ ਬਣੀ ਰਹੇ